ਲੋਕਡਾਊਨ ਵਿੱਚ ਮੋਬਾਇਲ ਲੈਪਟੋਪ ਦੀ ਜ਼ਿਆਦਾ ਵਰਤੋਂ ਤਾਂ ਸ਼ੁਰੂ ਹੋ ਗਈ ਹੈ ਬਸ ਇਸ ਪਰ ਇਸ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ ਵਰਕ ਫਰੋਮ ਹੋਮ ਜਾਂ ਔਨਲਾਈਨ ਸਕੂਲਿੰਗ ਵਿੱਚ ਇਹ ਚੀਜ਼ ਹੋਈ ਹੈ ਕਿ ਜੇ ਬਾਹਰ ਵਾਤਾਵਰਣ ਜਾਂ ਮਾਹੌਲ ਇੱਦਾਂ ਦਾ ਨਹੀਂ ਹੈ ਕਿ ਬੱਚਾ ਜਾਂ ਵੱਡੇ ਬਾਹਰ ਜਾ ਕੇ ਕੰਮ ਕਰ ਸਕਣ ਜਾਂ ਪੜ੍ਹ ਸਕਣ ਤਾਂ ਉਹਨਾਂ ਲਈ ਇੱਕ ਅਜਿਹੀ ਸੁਵਿਧਾ ਆ ਗਈ ਹੈ ਕਿ ਉਹ ਘਰ ਬਹਿ ਕੇ ਕੰਮ ਕਰ ਸਕਦੇ ਹਨ ਆਪਣੀ ਪੜ੍ਹਾਈ ਕਰ ਸਕਦੇ ਹਨ ਇਹਦੇ ਨਾਲ ਲੋਕਾਂ ਨੂੰ ਇਹ ਹੁੰਦਾ ਹੈ ਕਿ ਉਹ ਘਰ ਬੈਠੇ ਆਪਣੀ ਸਹੂਲੀਅਤ ਦੇ ਵਿੱਚ ਜਿਵੇਂ ਮਰਜ਼ੀ ਕੰਮ ਕਰ ਸਕਦੇ ਹਨ ਆਪਣਾ ਪੂਰਾ ਧਿਆਨ ਆਪਣੇ ਕੰਮ ਤੇ ਦੇ ਕੇ ਨਾਲ ਨਾਲ ਆਪਣਾ ਘਰ ਵੀ ਸਾਂਭ ਸਕਦੇ ਹਨ ਇਹ ਚੀਜ਼ ਜਿਵੇਂ ਕਿ ਹਾਊਸ ਵਾਈਫਸ ਨੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਉਹ ਆਪਣਾ ਘਰ ਵੀ ਸਾਂਭ ਸਕਦੇ ਹਨ ਅਤੇ ਔਨਲਾਈਨ ਜੇ ਉਹਨਾਂ ਨੂੰ ਕੋਈ ਕੰਮ ਮਿਲਦਾ ਹੈ ਤਾਂ ਉਹ ਵੀ ਕਰ ਸਕਦੇ ਹਨ ਮੇਰਾ ਔਨਲਾਈਨ ਸਕੂਲਿੰਗ ਜਾਂ ਘਰ ਦਾ ਘਰ ਤੋਂ ਕੰਮ ਦਾ ਤਜ਼ਰਬਾ ਬਹੁਤ ਹੀ ਵਧੀਆ ਰਿਹਾ ਹੈ ਕਿਉਂਕਿ ਜਿਵੇਂ ਹੁਣ ਇੰਨੀ ਠੰਡ ਪੈ ਰਹੀ ਹੈ ਅਤੇ ਇੰਨੀ ਠੰਡ ਵਿੱਚ ਕਿਸੇ ਦਾ ਵੀ ਬਾਹਰ ਜਾਣ ਦਾ ਮਨ ਨਹੀਂ ਕਰਦਾ ਅਤੇ ਉਹਨਾਂ ਨੂੰ ਇਹ ਹੀ ਹੁੰਦਾ ਕਿ ਉਹਨਾਂ ਨੂੰ ਘਰੋਂ ਕੰਮ ਮਿਲ ਜਾਵੇ ਜੋ ਕਿ ਮੈਨੂੰ ਮਿਲਿਆ ਹੈ ਅਤੇ ਮੈਨੂੰ ਬਹੁਤ ਸਹੂਲੀਅਤ ਮਹਿਸੂਸ ਹੁੰਦੀ ਹੈ ਕਿ ਹਾਂ ਜੇ ਕੰਮ ਕਰਨਾ ਹੈ ਤਾਂ ਅਸੀਂ ਘਰੋਂ ਵੀ ਕਰ ਸਕਦੇ ਹਾਂ ਲੋਕਡਾਊਨ ਤੋਂ ਪਹਿਲਾਂ ਇੱਦਾਂ ਦਾ ਕੋਈ ਨਹੀਂ ਸੀ ਕਿ ਹਾਂ ਅਸੀਂ ਘਰੋਂ ਵੀ ਕੰਮ ਕਰ ਸਕਦੇ ਹਾਂ ਜਾਂ ਇੱਦਾਂ ਵੀ ਕੰਮ ਹੋ ਸਕਦਾ ਇੱਦਾਂ ਵੀ ਪੜ੍ਹਾਈ ਹੋ ਸਕਦੀ ਹੈ ਬਟ ਜਦੋਂ ਦਾ ਲੋਕਡਾਊਨ ਹੋਇਆ ਹੈ ਉਸ ਤੋਂ ਬਾਅਦ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪੋਜੀਟਿਵ ਵੇਅ 'ਚ ਲਿੱਤਾ ਹੈ ਅਤੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪੋਜੀਟਿਵ ਤਰੀਕੇ ਨਾਲ ਅਪਣਾਇਆ ਹੈ ਉਹ ਆਪਣੇ ਕੰਮ ਕੰਮ ਪ੍ਰਤੀ ਬਹੁਤ ਹੀ ਜ਼ਿਆਦਾ ਲੀਨ ਹਨ ਅਤੇ ਉਹਨਾਂ ਨੂੰ ਇਸ ਗੱਲ ਦਾ ਵੀ ਹੈ ਕਿ ਸਾਡਾ ਘਰ ਵੀ ਚੰਗੀ ਤਰ੍ਹਾਂ ਚੱਲ ਰਿਹਾ ਹੈ ਅਤੇ ਇਹ ਚੀਜ਼ ਬਹੁਤ ਵਧੀਆ ਹੈ